ਹੈਲੋ ਸਰ ਮੈਂ ਕੋਲ ਕੀਤੀ ਸੀ ਕਿ ਕੱਲ੍ਹ ਰਾਤ ਅਸੀਂ ਗਿਆਰਾਂ ਕੁ ਵਜੇ ਮਤਲਬ ਪੀਜ਼ੇ ਔਡਰ ਕੀਤੇ ਸੀ ਕਿ ਜੋ ਕਿ ਮਤਲਬ ਪੀਜ਼ੇ ਜੋ ਕਿ ਸੀ ਸਾਢੇ ਬਾਰਾਂ ਵਜੇ ਤੱਕ ਮਤਲਬ ਸਾਡੇ ਤੱਕ ਪਹੁੰਚੇ ਨੇ ਘਰ ਗੈਸਟ ਆਏ ਹੋਏ ਸੀ ਜਿਨ੍ਹਾਂ ਨੂੰ ਅਸੀਂ ਮਤਲਬ ਡਿਨਰ ਲਈ ਸੱਦਿਆ ਸੀ ਉਹਨਾਂ ਅੱਗੇ ਮਤਲਬ ਪੇਸ਼ ਕਰਨੇ ਸੀ ਬਟ ਜਿਹੜੇ ਤੁਹਾਡੇ ਪੀਜ਼ੇ ਸੀ ਬਹੁਤ ਜ਼ਿਆਦਾ ਲੇਟ ਆਏ ਜੋ ਕਿ ਗਿਆਰਾਂ ਵਜੇ ਦੇ ਮੰਗਵਾਏ ਹੋਏ ਜੋ ਕਿ ਸਾਢੇ ਬਾਰਾਂ ਵਜੇ ਤੱਕ ਆਏ ਨੇ ਤੁਸੀਂ ਮਤਲਬ ਲਿਖ ਕੇ ਰ ਰੱਖਿਆ ਹੋਇਆ ਕਿ ਅੱਧੇ ਘੰਟੇ ਵਿੱਚ ਡਿਲੀਵਰੀ ਜਿਹੜੀ ਹੁੰਦੀ ਹੈ ਉਹ ਫਰੀ ਵੀ ਹੁੰਦੀ ਹੈ ਜੇ ਲੇਟ ਪਹੁੰਚਿਆ ਜਾਵੇ ਤਾਂ ਅਤੇ ਜੋ ਜਿਹੜੇ ਪੀਜ਼ੇ ਸੀ ਬਹੁਤ ਦੇਰ ਨਾਲ ਆਏ ਨੇ ਰਾਤ ਜਿਹੜੇ ਸਾਡੇ ਗੈਸਟ ਸੀ ਉਹ ਵੀ ਉੱਠ ਕੇ ਚਲੇ ਗਏ ਹੋਏ ਸੀ ਅਤੇ ਮੈਂ ਡਿਲੀਵਰੀ ਬੋਆਏ ਨਾਲ ਵੀ ਗੱਲ ਕੀਤੀ ਹੈ ਬਟ ਉਹਨਾਂ ਨੇ ਵੀ ਕੋਈ ਅੱਗੋਂ ਗੱਲਬਾਤ ਨਹੀਂ ਕੀਤੀ ਅਤੇ ਇਸ ਕਰਕੇ ਮੈਂ ਜਿਹੜਾ ਤੁਹਾਨੂੰ ਕੋਂਟੈਕਟ ਕਰ ਰਹੀ ਹਾਂ ਅਤੇ ਜਿਹੜੇ ਮੇਰੇ ਪੈਸੇ ਸੀ ਮੈਂ ਔਨਲਾਈਨ ਪੇਮੈਂਟ ਕੀਤੀ ਹੋਈ ਸੀ ਅਤੇ ਉਹ ਫਿਰ ਮੇਰਾ ਰਿਫੰਡ ਵਾਪਸ ਕੀਤਾ ਜਾਵੇ ਅਤੇ ਮੈਂ ਇਸ ਕਰਕੇ ਇੱਥੇ ਕੋਲ ਕੀਤੀ ਹੈ ਕਿ ਮੇਰੀ ਕੋਈ ਮਤਲਬ ਸੁਣਵਾਈ ਨਹੀਂ ਹੋ ਰਹੀ ਅਤੇ